ਮੇਰੇ ਇੱਕ ਦੋਸਤ ਜੋ ਕਿ ਸ਼ਹਿਰ ਵਿੱਚ ਰਹਿੰਦਾ ਹੈ ਨੂੰ ਬਾਗਬਾਨੀ ਦਾ ਸ਼ੌਂਕ ਸੀ ਉਸ ਤੇ ਘਰ ਵਿੱਚ ਖਾਲੀ ਜਗ੍ਹਾ 'ਤੇ ਉਹ ਬਗੀਚੀ ਬਣਾਉਣਾ ਚਾਹੁੰਦਾ ਸੀ ਉਸਨੇ ਮੈਨੂੰ ਮੇਰੇ ਬਾਗਬਾਨੀ ਦੇ ਸ਼ੌਂਕ ਕਰਕੇ ਯਾਦ ਕੀਤਾ ਮੈਂ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਜਦੋਂ ਮੈਂ ਉਸ ਕੋਲ ਗਿਆ ਤਾਂ ਉਸਨੇ ਮੈਨੂੰ ਆਪਣੇ ਘਰ ਵਿੱਚ ਪਈ ਖਾਲੀ ਅਤੇ ਕੱਚੀ ਜਗ੍ਹਾ ਦਿਖਾਈ ਜੋ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਉਸ ਨੇ ਚਾਹ ਪੀਂਦੇ ਪੀਂਦੇ ਮੈਨੂੰ ਆਪਣੀ ਸੋਚ ਦੱਸੀ ਕਿ ਉਹ ਇੱਥੇ ਕੀ ਕੁਝ ਦੇਖਣਾ ਚਾਹੁੰਦਾ ਹੈ ਉਹ ਆਪਣੇ ਘਰ ਵਿੱਚ ਹਰਿਆਲੀ ਦੇਖਣਾ ਚਾਹੁੰਦਾ ਸੀ ਮੈਂ ਉਸ ਦੀ ਮਦਦ ਕਰਨ ਲਈ ਤਿਆਰ ਸੀ ਅਸੀਂ ਚਾਹ ਪੀ ਕੇ ਸ਼ਹਿਰ ਤੋਂ ਬਾਹਰ ਨਰਸਰੀ ਵਿੱਚੋਂ ਦੋ ਬੋਰੀਆਂ ਅੰਗਰੇਜ਼ੀ ਪੋਲੋਗਰਾਸ ਲੈ ਕੇ ਆਏ ਕੁਝ ਫੁੱਲਾਂ ਵਾਲੇ ਪੌਦੇ ਜਿਵੇਂ ਗੁਲਦਾ ਗੁਲਾਬ ਗੁਲਦੌਦੀ ਕੈਕਟਸ ਐਲੋਵੀਰਾ ਮਹਿੰਦੀ ਲੈ ਕੇ ਆਏ ਕੁਝ ਗਮਲੇ ਲਏ ਅਤੇ ਕੁਝ ਫਲਦਾਰ ਬੂਟੇ ਜਿਵੇਂ ਕੇ ਅਮਰੂਦ ਅਨਾਰ ਪਪੀਤਾ ਕਿੰਨੂੰ ਵੀ ਲਏ ਸਜਾਵਟੀ ਬੂਟੇ ਜਿਵੇਂ ਕਿ ਪਾਮ ਵੇਲਾਂ ਆਦਿ ਵੀ ਲੈ ਲਏ ਅਤੇ ਇੱਕ ਮਾਲੀ ਦੀ ਮਦਦ ਨਾਲ ਅਸੀਂ ਇੱਕ ਦਿਨ ਵਿੱਚ ਹੀ ਸਭ ਕੁਝ ਲਗਾ ਦਿੱਤਾ ਘਰ ਦੇ ਅਗਲੇ ਪਾਸੇ ਇੱਕ ਵੇਲ ਚੜਾਈ ਅਤੇ ਪਾਮ ਲਗਾ ਦਿੱਤੇ ਵਿਚਾਲੇ ਅਤੇ ਪਿਛਲੇ ਪਾਸੇ ਫ਼ਲ ਵਾਲੇ ਬੂਟੇ ਪਪੀਤਾ ਅਮਰੂਦ ਲਗਾਏ ਘਰ ਦੇ ਵਿਚਕਾਰ ਅਨਾਰ ਲਗਾਇਆ ਅਤੇ ਉਸਦੇ ਆਸੇ ਪਾਸੇ ਐਲੋਵੀਰਾ ਲਗਾ ਦਿੱਤਾ ਘਾਹ ਨਾਲ ਸਾਰਾ ਜਗ੍ਹਾ ਬਹੁਤ ਸੋਹਣੀ ਲੱਗ ਰਹੀ ਸੀ ਗਮਲੇ ਵਿੱਚ ਫੁੱਲਾਂ ਵਾਲੇ ਬੂਟੇ ਸਜਾ ਦਿੱਤੇ ਜੋ ਕਿ ਬਹੁਤ ਸੋਹਣੇ ਲੱਗ ਰਹੇ ਸਨ ਇਹ ਅਨੁਭਵ ਮੇਰੀ ਜ਼ਿੰਦਗੀ ਦਾ ਬਹੁਤ ਹੀ ਸੋਹਣਾ ਰਿਹਾ ਅਤੇ ਉਸਨੂੰ ਮੈਂ ਇਹ ਕੁਝ ਸੁਝਾਅ ਦਿੱਤੇ ਕਿ ਇਸ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਵਿੱਚ ਸਮੇਂ ਸਮੇਂ ਖਾਦ ਪਾਣੀ ਅਤੇ ਦਵਾਈਆਂ ਜੋ ਕਿ ਕੀੜਿਆਂ ਨੂੰ ਮਾਰਨ ਉਹਨਾਂ ਨੂੰ ਪਾਉਂਦਾ ਰਹੀ ਤਾਂ ਜੋ ਇਹ ਬੂਟੇ ਹਮੇਸ਼ਾ ਫਲਦੇ ਫੁਲਦੇ ਰਹਿਣ ਅਤੇ ਤੇਰੀ ਫੁਲਵਾੜੀ ਹਮੇਸ਼ਾ ਮਹਿਕਦੀ ਰਹੇ